ਮੈਂ ਇੱਕ ਪੈਨ ਕਾਰਡ ਦੀ ਅਰਜੀ ਲਾਈ ਸੀ ਆਨਲਾਈਨ ਜੋ ਕਿ ਮੇਰਾ ਉਹਦੇ 'ਤੇ ਆਧਾਰ ਵੇਰਵਾ ਜੋ ਸੀਗਾ ਉਹ ਬਿਲਕੁਲ ਗਲਤ ਆਇਆ ਅਤੇ ਮੈਂ ਇਹਦੇ ਲਈ ਸੁਵਿਧਾ ਕੇਂਦਰ ਗਈ ਸੀ ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਮੈਡਮ ਵੀ ਜੋ ਤੁਹਾਡਾ ਆਧਾਰ ਦਾ ਵੇਰਵਾ ਆ ਇਹ ਇਹ ਮਿਸਪਲੇਸ ਹੋਣਾ ਆਮ ਗੱਲ ਆ ਠੀਕ ਹੈ ਇਹਦੇ ਲਈ ਤੁਹਾਨੂੰ ਤੁਸੀਂ ਐਪਲੀਕੇਸ਼ਨ ਦੁਬਾਰਾ ਲਿਖ ਦਓ ਜਿਹਦੇ ਕਰਕੇ ਤੁਹਾਡੀ ਜੋ ਤੁਹਾਡਾ ਆਧਾਰ ਆ ਸੋਰੀ ਜੋ ਆਧਾਰ ਦਾ ਵੇਰਵਾ ਆ ਉਹ ਪੈਨ ਕਾਰਡ ਦੇ ਉੱਤੇ ਨਵਾਂ ਆ ਜਾਏਗਾ ਠੀਕ ਹੈ ਅਤੇ ਉਹਦੇ ਲਈ ਉਹਨਾਂ ਨੇ ਮੈਨੂੰ ਕਿਹਾ ਕਿ ਐਪਲੀਕੇਸ਼ਨ ਕਰ ਦਿਓ ਅਤੇ ਐਪਲੀਕੇਸ਼ਨ ਮੈਂ ਲਿਖਤੀ ਅਤੇ ਉਹਦੇ ਉੱਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਡਾ ਜਿਹੜਾ ਪੈਨ ਕਾਰਡ ਦਾ ਆਧਾਰ ਵੇਰਵਾ ਜੋ ਤੁਹਾਡਾ ਪੈਨ ਕਾਰਡ ਆ ਉਹ ਦੋ ਹਫਤਿਆਂ ਤੱਕ ਬਣ ਕੇ ਆ ਜਾਏਗਾ ਅਤੇ ਉਹਦੇ ਲਈ ਮੈਨੂੰ ਉਹਨਾਂ ਨੇ ਮੇਰੇ ਪਰੂਫ ਮੰਗੇ ਅਤੇ ਉਹ ਮੇਰੇ ਆਧਾਰ ਵੇਰਵਾ ਜੋ ਮੇਰਾ ਓਰਿਜਨਲ ਸੀਗਾ ਮੈਂ ਉਹ ਦਿੱਤਾ ਉਹ ਤੋਂ ਬਾਅਦ ਉਹਨਾਂ ਨੇ ਮੇਰੇ ਆਧਾਰ ਦੇ ਉੱਤੇ ਸ ਸਾਈਨ ਵਗੈਰਾ ਕਰਵਾਏ ਜੋ ਮੇਰੀ ਫੋਟੋ ਸੀ ਉਹ ਵੀ ਲਗਵਾਈ ਔਰ ਜੋ ਪੁਰਾਣੇ ਵਾਲਾ ਸੀਗਾ ਉਹ ਮੇਰੇ ਵੇਸਟ ਦੇ ਵਿੱਚ ਚਲਾ ਗਿਆ ਡਿਸਟਰੋਏ ਕਰਤਾ ਮੈਂ